ਮੈਂ ਆਪਣੇ ਨੇੜੇ ਦੇ ਕਸਬਿਆਂ ਜਿਸ ਤਰ੍ਹਾਂ ਜਲੰਧਰ ਲੁਧਿਆਣਾ ਚੰਡੀਗੜ੍ਹ ਹੋਇਆ ਅਤੇ ਕਈ ਵਾਰੀ ਜਾਂਦੇ ਆਉਂਦੇ ਰਹਿੰਦੇ ਹਾਂ ਅਤੇ ਆਮ ਤੌਰ 'ਤੇ ਕਦੇ ਕੋਈ ਸੁੱਖ ਹੋ ਗਿਆ ਜੇ ਕੋਈ ਸੁੱਖ ਦੁੱਖ ਵਿੱਚ ਹੀ ਇਹ ਚੀਜ਼ਾਂ 'ਤੇ ਆਇਆ ਜਾਇਆ ਜਾਂਦਾ ਹੈ ਜੇ ਕੋਈ ਜੰਮ ਪਿਆ ਜਾਂ ਕਿਸੇ ਦੀ ਡੈੱਥ ਹੋ ਗਈ ਫਿਰ ਹੀ ਉੱਥੇ ਆਵਾਂਗੇ ਜਾਵਾਂਗੇ ਜਾਂ ਕਿਸੇ ਕੋਈ ਸ਼ਾਦੀ ਵਿਆਹ ਦੇ ਮਾਹੌਲ 'ਤੇ ਜਿਹਦੇ ਨਾਲ ਘਰ ਦੇ ਸਾਰਿਆਂ ਨੇ ਪਰਿਵਾਰ ਵਾਲਿਆਂ ਨੇ ਸ਼ਾਦੀ ਵਗੈਰਾ ਕੋਈ ਹੋਈ ਤਾਂ ਜਾਣਾ ਹੁੰਦਾ ਉੱਥੇ ਜਾ ਕੇ ਆਪਣਾ ਇੱਕ ਤਾਂ ਸਭ ਨੂੰ ਭੈਣ ਭਰਾ ਬੰਦਾ ਆਪਸ 'ਚ ਮਿਲ ਜਾਂਦੇ ਹਨ ਸੁੱਖ ਦੁੱਖ ਦਾ ਪਤਾ ਲੱਗਦਾ ਹੈ ਅਤੇ ਫੰਕਸ਼ਨ ਕੋਈ ਹੋਵੇ ਫੰਕਸ਼ਨ ਵੀ ਫਿਰ ਅਟੈਂਡ ਇਸ ਤਰ੍ਹਾਂ ਹੋ ਜਾਂਦਾ ਚਲੋ ਮਿਲਣ ਨਾਲ ਹੀ ਦੁਨੀਆ ਇਸ ਤਰ੍ਹਾਂ ਹੀ ਹੈ ਇੱਕ ਦੂਜੇ ਬੰਦਿਆਂ ਨੂੰ ਮਿਲਣਾ ਵੀ ਚਾਹੀਦਾ ਹੈ ਮਿਲਣ ਨਾਲ ਪਿਆਰ ਵੱਧਦਾ ਹੈ ਅਤੇ ਇੱਕ ਦੂਜੇ ਦਾ ਸੁੱਖ ਦੁੱਖ ਦਾ ਸਾਂਝ ਹੁੰਦੀ ਹੈ ਅਤੇ ਸੁੱਖ ਦੁੱਖ ਦਾ ਪਤਾ ਲੱਗਦਾ ਹੈ ਇਸੇ ਇਸ ਲਈ ਆਮ ਤੌਰ 'ਤੇ ਇਸ ਉਦੇਸ਼ਾਂ ਨਾਲ ਹੀ ਅਸੀਂ ਆਪਣੇ ਨੇੜੇ ਦੇ ਕਸਬਿਆਂ ਤੇ ਮੈਂ ਕਈ ਵਾਰੀ ਆਉਂਦਾ ਜਾਂਦਾ ਹਾਂ ਮਿਹਰਬਾਨੀ